ਸਕੈਚਿੰਗ ਇਸ ਤਕਨੀਕ ਦੀ ਵਰਤੋਂ ਨਾਲ ਮੈਂ ਵੱਖ ਵੱਖ ਟੈਕਸਟ ਬਣਾ ਸਕਦਾ ਹਾਂ ਜਿਵੇਂ ਕਿ ਚਮੜੀ ਜਾਂ ਫੈਬਰਿਕ ਕਰਮ ਕਰ ਸਕੈਚਿੰਗ ਇਸ ਤਕਨੀਕ ਦੀ ਵਰਤੋਂ ਨਾਲ ਮੈਂ ਵੱਖ ਵੱਖ ਟੈਕਸਟ ਬਣਾ ਸਕਦਾ ਹਾਂ ਜਿਵੇਂ ਕਿ ਰੁੱਖ ਦੀ ਸਟਿਪਲਿੰਗ ਇਸ ਤਕਨੀਕ ਦੀ ਵਰਤੋਂ ਨਾਲ ਮੈਂ ਵੱਖ ਵੱਖ ਟੈਕਸਟ ਬਣਾ ਸਕਦਾ ਹਾਂ ਜਿਵੇਂ ਕਿ ਫੈਬਰਿਕ ਜਾਂ ਚਮੜੀ ਸਕੈਚਿੰਗ ਇਸ ਤਕਨੀਕ ਇਸ ਦੀ ਵਰਤੋਂ ਨਾਲ ਮੈਂ ਵੱਖ ਵੱਖ ਟੈਕਸਟ ਬਣਾ ਸਕਦਾ ਹਾਂ ਜਿਵੇਂ ਕਿ ਰੁੱਖ ਦੀ ਸੱਖ ਰੰਗ ਅਤੇ ਛਾਹੀਆਂ ਦੀ ਵਰਤੋਂ ਇਸ ਤਕਨੀਕ ਦੀ ਵਰਤੋਂ ਨਾਲ ਮੈਂ ਵੱਖ ਵੱਖ ਟੈਕਸਟ ਬਣਾ ਸਕਦਾ ਹਾਂ ਜਿਵੇਂ ਕਿ ਚਮੜੀ ਜਾਂ ਫੈਬਰਿਕ ਇਹਨਾਂ ਤਕਨੀਕਾਂ ਦੀ ਵਰਤੋਂ ਨਾਲ ਮੈਂ ਆਪਣੀਆਂ ਡਰਾਇੰਗਾਂ ਵਿੱਚ ਵੱਖ ਵੱਖ ਟੈਕਸਟ ਬਣਾ ਸਕਦਾ ਹਾਂ